ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੋਲਵੋ ਕੰਪਨੀ ਬੱਸ ਵਾਲੇ ਬੋਲਣ ਡੇ ਹੋ ਅਸੀਂ ਹਰਿਆਣੇ ਤੋਂ ਬੋਲ ਰਹੇ ਹਾਂ ਇੱਥੇ ਅਸੀਂ ਪੰਜਾਬ ਘੁੰਮਣਾ ਹੈ ਸਾਡੀ ਹਾਂਜੀ ਤੁਹਾਡੀਆਂ ਬੱਸਾਂ ਮਤਲਬ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਸੁਵਿਧਾ ਮਿਲੇਗੀ ਸਾਨੂੰ ਅਸੀਂ ਘੁੰਮਣਾ ਹੋਵੇ ਜੇ ਹਾਂਜੀ ਹਾਂਜੀ ਅਤੇ ਹੋਰ ਤੁਹਾਡੀਆਂ ਬੱਸਾਂ ਦੇ ਵਿੱਚ ਮਤਲਬ ਏ ਸੀ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਛਾ ਚਲੋ ਵਧੀਆ ਠੀਕ ਹੈ ਅਸੀਂ ਫਿਰ ਜਲਦੀ ਹੀ ਆਪਣੀ ਫੈਮਲੀ ਨਾਲ ਆ ਰਹੇ ਘੁੰਮਣ ਸਾਨੂੰ ਟਾਈਮ ਦੱਸੋ ਮਤਲਬ ਕਿਸ ਤਰ੍ਹਾਂ ਵਾਪਸ ਜੇ ਅਸੀਂ ਜਾਣਾ ਹੋਵੇ ਸਾਨੂੰ ਕਦੋਂ ਬੱਸ ਮਿਲੇਗੀ ਇਸ ਤਰ੍ਹਾਂ ਅਤੇ ਵਾਪਸ ਜਾਣਾ ਹੋਵੇ ਅਸੀਂ ਤਾਂ ਫਿਰ ਵੀ ਸਾਨੂੰ ਪੂਰੇ ਟਾਈਮ 'ਤੇ ਪਹੁੰਚਾਇਆ ਜਾਵੇਗਾ ਚਲੋ ਵਧੀਆ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ